ਨੌ ਅਕਤੂਬਰ ਦੋ ਜੀਰੋ ਜੀਰੋ ਦੋ ਸੱਤ ਦਸੰਬਰ ਦੋ ਜੀਰੋ ਜੀਰੋ ਅੱਠ ਅੱਠ ਮਈ ਦੋ ਜੀਰੋ ਜੀਰੋ ਚਾਰ ਚਾਰ ਜਨਵਰੀ ਦੋ ਦੋ ਦੋ ਜੀਰੋ ਜੀਰੋ ਸੱਤ ਪੰਜ ਜੂਨ ਦੋ ਜੀਰੋ ਜੀਰੋ ਇੱਕ